ਖੇਡਾਂ ਸਾਡੀ ਜ਼ਿੰਦਗੀ ਦਾ ਬਹੁਤ ਹੀ ਅਨਿੱਖੜਵਾਂ ਅੰਗ ਹਨ ਖੇਡਾਂ ਸਾਡੇ ਸਰੀਰ ਨੂੰ ਦਿਮਾਗੀ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਬਣਾਉਂਦੀਆਂ ਹਨ ਖੇਡਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਇੱਕ ਆਊਟਡੋਰ ਖੇਡਾਂ ਜਿਨ੍ਹਾਂ ਨੂੰ ਕਿ ਬਾਹਰੀ ਖੇਡਾਂ ਕਿਹਾ ਜਾਂਦਾ ਹੈ ਅਤੇ ਦੂਜੀਆਂ ਅੰਦਰੂਨੀ ਖੇਡਾਂ ਜਿਨ੍ਹਾਂ ਨੂੰ ਇਨਡੋਰ ਖੇਡਾਂ ਕਿਹਾ ਜਾਂਦਾ ਹੈ ਇਨਡੋਰ ਖੇਡਾਂ ਜਿਵੇਂ ਕਿ ਲੂਡੋ ਕੈਰਮ ਸੱਪ ਅਤੇ ਪੌੜੀ ਸਤਰੰਜ ਮਾਰਬਲ ਅਸੀਂ ਕੋਈ ਵੀ ਖੇਡ ਆਪਣੇ ਮਨ ਪਰਚਾਵੇ ਲਈ ਖੇਡ ਸਕਦੇ ਹਾਂ ਮੇਰੀ ਮਨਭਾਉਂਦੀ ਖੇਡ ਕੈਰਮ ਬੋਰਡ ਹੈ ਕਿਉਂਕਿ ਇਸ ਨਾਲ ਮੈਂ ਬੱਚਿਆਂ ਵਿੱਚ ਬਹਿ ਕੇ ਆਪਣੇ ਪਰਿਵਾਰ ਵਿੱਚ ਬਹਿ ਕੇ ਉਹਨਾਂ ਨਾਲ ਇਹ ਖੇਡ ਖੇਡ ਸਕਦਾ ਹਾਂ ਇਸ ਤੋਂ ਬਿਨਾਂ ਸ਼ਤਰੰਜ ਦੀ ਖੇਡ ਬਹੁਤ ਹੀ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਹੈ ਪੁਰਾਣੇ ਰਾਜੇ ਮਹਾਰਾਜੇ ਆਪਣੇ ਆਪਣੀਆਂ ਰਾਣੀਆਂ ਅਤੇ ਵਜ਼ੀਰਾਂ ਨਾਲ ਬਹਿ ਕੇ ਇਹ ਖੇਡ ਖੇਡਦੇ ਸਨ ਜੋ ਕਿ ਰਾਜਨੀਤਿਕ ਦਾ ਇੱਕ ਬਹੁਤ ਹੀ ਵਧੀਆ ਸਾਧਨ ਮੰਨਿਆ ਜਾਂਦਾ ਸੀ ਖੇਡ ਭਾਵੇਂ ਕੋਈ ਵੀ ਹੋਵੇ ਸਾਡੇ ਸਰੀਰ ਨੂੰ ਅਤੇ ਦਿਮਾਗ ਨੂੰ ਤੰਦਰੁਸਤ ਬਣਾਉਂਦੀ ਹੈ ਧੰਨਵਾਦ